ਕੱਪੜੇ ਧੋਣ ਲਈ ਸਭ ਤੋਂ ਪਹਿਲਾਂ ਕੱਪੜਿਆਂ ਨੂੰ ਉਹਨਾਂ ਦੇ ਰੰਗ ਦੇ ਹਿਸਾਬ ਅਨੁਸਾਰ ਵੱਖ ਵੱਖ ਵੰਡਣਾ ਚਾਹੀਦਾ ਹੈ ਤਾਂ ਜੋ ਗੂੜੇ ਰੰਗ ਦੇ ਕੱਪੜੇ ਹਲਕੇ ਰੰਗਾਂ ਨਾਲ ਮਿਲ ਕੇ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਉਣ ਉਸ ਤੋਂ ਬਾਅਦ ਕੱਪੜਿਆਂ 'ਤੇ ਲੱਗੇ ਲੇਬਲ ਪੜ੍ਹ ਕੇ ਉਹਨਾਂ ਦੀ ਧੋਣ ਦੀ ਸਹੀ ਤਰੀਕਾ ਸਮਝਣਾ ਚਾਹੀਦਾ ਹੈ ਨਾਜੁਕ ਕੱਪੜਿਆਂ ਨੂੰ ਹੱਥ ਨਾਲ ਜਾਂ ਕੋਮਲ ਸੋਡੇ ਅਤੇ ਮਸ਼ੀਨ ਵਿੱਚ ਧੋਣਾ ਚਾਹੀਦਾ ਹੈ ਗੰਦੇ ਤੇ ਦਾਗ ਵਾਲੇ ਕੱਪੜਿਆਂ ਨੂੰ ਪਹਿਲਾਂ ਥੋੜ੍ਹਾ ਗਿੱਲਾ ਕਰਕੇ ਉਹਨਾਂ 'ਤੇ ਡਿਟਰਜੈਂਟ ਲਗਾ ਲਓ ਕੁਝ ਸਮੇਂ ਲਈ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਦਾਗ ਆਸਾਨੀ ਨਾਲ ਹਟ ਸਕਣ ਧੋਣ ਸਮੇਂ ਉਚਿਤ ਮਾਤਰਾ ਵਿੱਚ ਸਾਬਣ ਜਾਂ ਡਿਟਰਜੈਂਟ ਵਰਤਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਝੱਗ ਬਣਨਾ ਵੀ ਮਸ਼ੀਨ ਜਾਂ ਕੱਪੜਿਆਂ ਲਈ ਠੀਕ ਨਹੀਂ ਹੁੰਦਾ ਗਰਮ ਪਾਣੀ ਚਿੱਟੇ ਕੱਪੜਿਆਂ ਲਈ ਵਰਤਿਆ ਜਾ ਸਕਦਾ ਹੈ ਪਰ ਰੰਗੀਨ ਕੱਪੜਿਆਂ ਲਈ ਥੋੜ੍ਹਾ ਠੰਡਾ ਪਾਣੀ ਚੰਗਾ ਰਹੇਗਾ ਧੋਣ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਸਾਫ ਥਾਂ 'ਤੇ ਸਕਾਉਣਾ ਚਾਹੀਦਾ ਹੈ ਅਤੇ ਦੁਪਹਿਰ ਦੀ ਤਿੱਖੀ ਧੁੱਪ ਤੋਂ ਬਚਾਉਣਾ ਚਾਹੀਦਾ ਹੈ ਤਾਂ ਜੋ ਕੱਪੜਿਆਂ ਦੇ ਰੰਗ ਖ਼ਰਾਬ ਨਾ ਹੋ ਸਕਣ ਜ਼ਿਆਦਾ ਸੰਵੇਦਨਸ਼ੀਲ ਕੱਪੜਿਆਂ ਨੂੰ ਥੱਲੇ ਹਵਾ ਵਿੱਚ ਹੀ ਛਾਵੇ ਸੁਕਾਉਣਾ ਚਾਹੀਦਾ ਹੈ ਪਰੈੱਸ ਕਰਦੇ ਸਮੇਂ ਉਹਨਾਂ ਦੀ ਗਰਮੀ ਦੇ ਪੱਧਰ ਨੂੰ ਜਾਂਚਣਾ ਚਾਹੀਦਾ ਹੈ ਤਾਂ ਜੋ ਕੱਪੜੇ ਜਲਣ ਨਾ ਅਤੇ ਨਾ ਹੀ ਖ਼ਰਾਬ ਹੋਣ